ਮੈਂ ਇੱਕ ਨਵੀਂ ਪ੍ਰੈੱਸ ਲਿਆਇਆ ਸੀਗਾ ਜੀ ਪ੍ਰੈੱਸ ਦੇ ਤਾਂ ਪ੍ਰੈੱਸ ਖੋਲ੍ਹਣ 'ਤੇ ਇਹਦਾ ਡੱਬਾ ਵੀ ਖਰਾਬ ਸੀਗਾ ਡੱਬੇ 'ਚ ਜੋ ਪ੍ਰੈੱਸ ਬਾਹਰ ਕੱਢੀ ਤਾਂ ਉਹਦੇ ਹੈਂਡ ਹੈਂਡਲ ਵੀ ਟੁੱਟਿਆ ਹੋਇਆ ਸੀਗਾ ਅਤੇ ਉਹਦੀ ਤਾਰਾਂ ਵੀ ਖਰਾਬ ਸੀਗੀਆਂ ਮੈਂ ਠੀਕ ਕਰਾ ਕੇ ਉਸ ਯੋਜ ਕੀਤਾ ਠੀ ਉਸ ਤੋਂ ਬਾਅਦ ਵੀ ਉਹ ਬਿਲਕੁਲ ਕੱਪੜੇ 'ਚੋਂ ਵਲ਼ ਨਹੀਂ ਕੱਢ ਰਹੀ ਸੀਗੀ ਵਲ਼ ਕੀ ਕੱਢਣੇ ਉਹਦੇ ਚੱਲਣ ਸਾਨੂੰ ਕਰੰਟ ਵੀ ਲੱਗ ਗਿਆ ਜਿਸ ਕਰਕੇ ਮੈਂ ਪ੍ਰੈੱਸ ਜਿਹੜੀ ਖਰੀਦੀ ਹੈ ਉਹਦੇ ਪੈਸੇ ਮੇਰੇ ਬਿਲਕੁਲ ਬੇਕਾਰ ਹੋਏ ਨੇ ਕੋਈ ਫਾਇਦਾ ਨਹੀਂ ਹੋਇਆ ਪ੍ਰੈੱਸ ਲੈਣੇ ਦਾ ਮੈਨੂੰ